ਸਾਡਾ ਮਨ ਪਸੰਦ ਖਾਣਾ ਘਰ ਬਣਿਆ ਹੋਇਆ ਜੋ ਵੀ ਖਾਣਾ ਬਹੁਤ ਪਸੰਦ ਹੈ ਕਿਉਂਕਿ ਘਰ ਜੋ ਵੀ ਖਾਣਾ ਬਣਦਾ ਹੈ ਬਹੁਤ ਹੀ ਸਾਫ ਸਫਾਈ ਨਾਲ ਬਣਦਾ ਹੈ ਮੇਨ ਸਾਨੂੰ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਬਹੁਤ ਪਸੰਦ ਹੈ ਘਰੇ ਬਣਿਆ ਮੱਕੀ ਦਾ ਰੋਟੀ ਅਤੇ ਸਰ੍ਹੋਂ ਦਾ ਸਾਗ ਬਹੁਤ ਹੀ ਆਪਾਂ ਘਰੇ ਸਾਫ ਸੁਥਰਾ ਤਰੀਕੇ ਨਾਲ ਬਣਾਉਂਦੇ ਹਾਂ ਅਗਰ ਉਹੀ ਖਾਣਾ ਸਾਨੂੰ ਬਾਹਰ ਖਾਣਾ ਪੈ ਜੇ ਬਾਹਰ ਹੋਟਲਾਂ 'ਚ ਕੋਈ ਵੀ ਸਫਾਈ ਨਹੀਂ ਹੁੰਦੀ ਮਾੜੇ ਹਾਲ ਨੇ ਆਪਾਂ ਘਰ ਬੈਠ ਕੇ ਪਰਿਵਾਰ ਨਾਲ ਜੋ ਵੀ ਰੋਟੀ ਪਾਣੀ ਖਾ ਰਹੇ ਹਾਂ ਉਹਦਾ ਅਲੱਗ ਹੀ ਆਨੰਦ ਹੈ ਘਰੇ ਫੈਮਿਲੀ ਨਾਲ ਬੱਚੇ ਵੀ ਸਾਰੇ ਇਹ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਖਾਣਾ ਬਹੁਤ ਪਸੰਦ ਕਰਦੇ ਹਨ ਜਿਸ ਦਿਨ ਵੀ ਬਣਦਾ ਹੈ ਸਾਰਾ ਪਰਿਵਾਰ ਖੁਸ਼ ਹੋ ਕੇ ਖਾਂਦਾ ਹੈ